ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਤੇਰਾਂ ਸਤੰਬਰ ਉੱਨੀ ਸੌ ਬਿਆਸੀ ਤਿੰਨ ਜੂਨ ਉੱਨੀ ਸੌ ਬਿਆਸੀ ਅੱਠ ਅਗਸਤ ਦੋ ਹਜ਼ਾਰ ਨੌਂ ਤੀਹ ਨਵੰਬਰ ਦੋ ਹਜ਼ਾਰ ਅੱਠ